ਘਰ ਦੀ ਰਸੋਈ ਵਿੱਚ ਬਹੁਤ ਸਾਰੇ ਬਰਤਨ ਪਏ ਹੁੰਦੇ ਹਨ ਜੋ ਕਿ ਵੱਖ ਵੱਖ ਕੰਮਾਂ ਲਈ ਵਰਤੇ ਜਾਂਦੇ ਹਨ ਜਿਵੇਂ ਕਿ ਪ੍ਰਾਂਤ ਚਕਲਾ ਵੇਲਨਾ ਕੜਾਈ ਪਤੀਲਾ ਕੜਛੀ ਚਮਚ ਪਲੇਟ ਡੋਂਗਾ ਤਵਾ ਚਾਕੂ ਚਾਹ ਦੇ ਕੱਪ ਗਰਮ ਰੋਟੀ ਵਾਲਾ ਡੱਬਾ ਆਦਿ ਪ੍ਰਾਂਤ ਅਸੀਂ ਆਟਾ ਗੁੰਨਣ ਲਈ ਵਰਤਦੇ ਹਾਂ ਚੱਕਲਾ ਬੇਲਣਾ ਪੇੜਾ ਕਰਕੇ ਰੋਟੀ ਬਣਾਉਣ ਦੇ ਲਈ ਵਰਤਦੇ ਹਾਂ ਕੜਾਹੀ ਕੜਛੀ ਆਦਿ ਸਬਜ਼ੀ ਵਗੈਰਾ ਬਣਾਉਣ ਲਈ ਵਰਤੀ ਜਾਂਦੀ ਹੈ ਪਤੀਲਾ ਦਾਲ ਵਗੈਰਾ ਬਣਾਉਣ ਲਈ ਵਰਤਿਆ ਜਾਂਦਾ ਹੈ ਚਮਚ ਅਤੇ ਪਲੇਟਾਂ ਰੋਟੀ ਪਾਣੀ ਖਾਣ ਦੇ ਲਈ ਵਰਤੀਆਂ ਜਾਂਦੀਆਂ ਹਨ ਡੋਂਗਾ ਰੋਟੀ ਜਾਂ ਦਾਲ ਸਬਜ਼ੀ ਵਗੈਰਾ ਸਰਵ ਕਰਨ ਲਈ ਵਰਤਿਆ ਜਾਂਦਾ ਹੈ ਚਾਕੂ ਅਸੀਂ ਸਬਜ਼ੀਆਂ ਨੂੰ ਕੱਟਣ ਲਈ ਵਰਤੋਂ ਕਰਦੇ ਹਾਂ ਛੋਟੀ ਪਤੀਲੀ ਜਾਂ ਫਰਾਈ ਪੈਨ ਇਹਦੇ ਵਿੱਚ ਅਸੀਂ ਚਾਹ ਬਣਾਉਂਦੇ ਹਾਂ ਅਤੇ ਚਾਹ ਦੇ ਕੱਪ ਚਾਹ ਪੀਣ ਲਈ ਵਰਤੇ ਜਾਂਦੇ ਹਨ ਉਸ ਤੋਂ ਬਾਅਦ ਇੱਕ ਵੱਡੇ ਵੱਡੇ ਗਲਾਸ ਲੱਸੀ ਦੇ ਗਲਾਸ ਵੀ ਹੁੰਦੇ ਹਨ ਜੋ ਕਿ ਲੱਸੀ ਪੀਣ ਲਈ ਵਰਤੇ ਜਾਂਦੇ ਹਨ ਛੋਟੇ ਗਲਾਸ ਪਾਣੀ ਪੀਣ ਲਈ ਜਾਂ ਕੰਚ ਦੇ ਗਲਾ ਸ਼ਰਬਤ ਬਣਾਉਣ ਜਾਂ ਮਹਿਮਾਨਾਂ ਨੂੰ ਪਲਾਉਣ ਲਈ ਵਰਤੇ ਜਾਂਦੇ ਹਨ ਅੱਜ ਕੱਲ੍ਹ ਰਸੋਈ ਵਿੱਚ ਮਾਈਕਰੋਵੇਵ ਓਵਨ ਆਦਿ ਵਰਤਿਆ ਜਾਂਦਾ ਹੈ ਅਤੇ ਉਸਦੇ ਭਾਂਡੇ ਵੱਖਰੇ ਵੱਖਰੇ ਹੁੰਦੇ ਹਨ ਉਹ ਚੰਗੇ ਪਲਾਸਟਿਕ ਦੇ ਟੈਂਪਰੇਚਰ 'ਤੇ ਵਰਤੇ ਜਾਣ ਲਈ ਸਪੈਸ਼ਲ ਭਾਂਡੇ ਹੁੰਦੇ ਹਨ ਉਹ ਵੀ ਅੱਜ ਕੱਲ੍ਹ ਰਸੋਈਆਂ ਵਿੱਚ ਪਾਏ ਜਾਂਦੇ ਹਨ ਉਹ ਅੱਜ ਕੱਲ੍ਹ ਜਿੰਨੇ ਵੀ ਭਾਂਡੇ ਆਉਂਦੇ ਹਨ ਸਾਰੇ ਗੈਸ ਚੁੱਲ੍ਹੇ ਅਤੇ ਇੰਡਕਸ਼ਨ ਦੀ ਵਰਤੋਂ ਉੱਤੇ ਕੀਤੇ ਜਾਂਦੇ ਹਨ